ਮੈਂ ਨਾ ਇੱਕ ਵਾਰੀ ਸਮਾਰਟ ਵਾਚ ਔਡਰ ਕੀਤੀ ਸੀਗੀ ਅਤੇ ਅ ਮ ਬੀਕੋਜ ਮੈਂ ਦੇਖ ਰਿਹਾ ਸੀ ਮੈਂ ਸਕਰੋਲ ਕਰ ਰਿਹਾ ਸੀ ਫੋਨ 'ਤੇ ਅਤੇ ਮੈਨੂੰ ਬੜੀ ਚੰਗੀ ਲੱਗੀ ਅਤੇ ਉਹਦੇ ਫੀਚਰਸ ਬੜੇ ਅੱਛੇ ਸੀ ਵਾਟਰ ਪਰੂਫ ਸੀ ਡਿਸਪਲੇਅ ਕਾਫੀ ਲਾਰਜ ਸੀ ਅਤੇ ਹੋਰ ਕਾਫੀ ਫੀਚਰ ਸੀ ਬਲਿਉਟੁਥ ਸੀ ਵੀ ਕੈਨ ਅਸੀਂ ਕੰਟੈਕਟ ਕਰ ਸਕਦੇ ਸੀ ਫੋਨ ਨਾਲ ਮਤਲਬ ਮੈਂ ਬੜਾ ਪ੍ਰਭਾਵਿਤ ਹੋਇਆ ਉਸ ਤੋਂ ਅਤੇ ਮੈਂ ਆਪਣਾ ਔਡਰ ਬੁੱਕ ਕਰਤਾ ਬਿਕੋਜ਼ ਅ ਕੁਛ ਹੀ ਰਹਿ ਗਏ ਸੀ ਕੁਛ ਹੀ ਵਾਚਿਸ ਰਹਿ ਗਈਆਂ ਸੀ ਸਮਾਰਟ ਵਾਚ ਸੋ ਮੈਂ ਮਿਸ ਨਹੀਂ ਕਰਨਾ ਚਾਹੁੰਦਾ ਇਸ ਕਰਕੇ ਮੈਂ ਆਪਣਾ ਔਡਰ ਪਲੇਸ ਕਰਤਾ ਅਤੇ ਆਫਟਰ ਮੈ ਮੈਨੂੰ ਲੱਗਦਾ ਦੋ ਦਿਨ ਤੋਂ ਬਾਅਦ ਮੈਨੂੰ ਔਡਰ ਮਿਲ ਗਿਆ ਅਤੇ ਮੈਂ ਬੜਾ ਖੁਸ਼ ਹੋਇਆ ਵੈਨ ਜਦੋਂ ਮੈਂ ਉਹਨੂੰ ਖੋਲਿਆ ਬਟ ਆਫਟਰ ਆਫਟਰ ਆਈ ਥਿੰਕ ਦੋ ਤਿੰਨ ਦਿਨ ਤੋਂ ਬਾਅਦ ਜਦੋਂ ਮੈਂ ਯੂਜ਼ ਕੀਤਾ ਸੋ ਦੈਨ ਮੈਨੂੰ ਮਹਿਸੂਸ ਹੋਇਆ ਇੱਟ ਵਾਜ ਵੈਰੀ ਚੀਪ ਅਤੇ ਚੀਪ ਵੀ ਸੀ ਕੁਆਲਿਟੀ ਵੀ ਅੱਛੀ ਨਹੀਂ ਸੀ ਅਤੇ ਡਿਸਪਲੇਅ ਵੀ ਅੱਛੀ ਨਹੀਂ ਸੀ ਬਲੱਰ ਦਿਖਦਾ ਸੀ ਅਤੇ ਫੀਚਰਸ ਜੋ ਦੱਸੇ ਸੀ ਉਹ ਨਹੀਂ ਸੀ ਉਹਦੇ ਵਿੱਚ ਬੜਾ ਡਿਸਪੋਇੰਟਡ ਹੋਇਆ ਅਤੇ ਉਸ ਤੋਂ ਬਾਅਦ ਮੈਨੂੰ ਇੱਥੇ ਜਸਟ ਮੈਂ ਕੀਤਾ ਵੀ ਦਿਸ ਇਜ ਏ ਫੇਕ ਇਨਫੋਰਮੇਸ਼ਨ ਸਾਰੀ ਫੇਕ ਇਨਫੋਮੇਸ਼ਨ ਸੀ ਅਤੇ ਮੈਂ ਪੈਸੇ ਵੀ ਚਾਰਜ ਕੀਤੇ ਅਤੇ ਮੈਂ ਰਿਕੁਐਸਟ ਵੀ ਪਾਈ ਹੈ ਅਤੇ ਮੈਂ ਵਾਪਸ ਰੀਫੰਡ ਕੀਤਾ ਮਨੀ ਕਿਉਂਕਿ ਇਟਸ ਵੈਰੀ ਚੀਪ ਦੈਟ ਬਹੁਤ ਬਹੁਤ ਹੀ ਘਟੀਆ ਪ੍ਰੋਡੈਕਟ ਸੀ ਬਹੁਤ ਹੀ ਘਟੀਆ ਸਮਾਟ ਵਾਚ ਸੀ